ਪੰਜਾਬੀ ਸੱਭਿਆਚਾਰ ਦਾ ਘੇਰਾ ਬਹੁਤ ਜ਼ਿਆਦਾ ਵਿਸ਼ਾਲ ਹੈ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਲੋਕ ਕਲਾਵਾਂ ਲੋਕ ਸਾਜ਼ ਲੋਕ ਕਿਰਤਾਂ ਆਦਿ ਸ਼ਾਮਿਲ ਹਨ ਲੋਕ ਕਲਾਵਾਂ ਦੇ ਰੂਪ ਦੇ ਵਿੱਚ ਸਾਡੇ ਕੋਲ ਹੱਥੀਂ ਕਿਰਤਾਂ ਦੇ ਨਮੂਨੇ ਜਿਵੇਂ ਕਿ ਫੁੱਲਕਾਰੀ ਕੱਢਣਾ ਦਰੀਆਂ ਬੁਣਨਾ ਪੱਖੀਆਂ ਬੁਣਨਾ ਇਹ ਸਾਰੇ ਮੌਜੂਦ ਸਨ ਅਤੇ ਇਹ ਸਾਰੇ ਪ੍ਰਾਚੀਨ ਨਮੂਨੇ ਹਨ ਜਿਹੜੇ ਕਿ ਉਸ ਸਮੇਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਸਨ ਪਰੰਤੂ ਆਧੁਨਿਕ ਪਦਾਰਥਵਾਦੀ ਯੁੱਗ ਦੇ ਪ੍ਰਭਾਵ ਦੇ ਕਾਰਨ ਇਹਨਾਂ ਦਾ ਰੂਪ ਪਰਿਵਰਤਿਤ ਹੋ ਰਿਹਾ ਹੈਗਾ ਮੰਡੀਕਰਨ ਦੇ ਪ੍ਰਭਾਵ ਦੇ ਕਰਨ ਇਹ ਲੋਕ ਕਲਾਵਾਂ ਜਿਹੜੀਆਂ ਖਤਮ ਹੋ ਰਹੀਆਂ ਹਨ ਅਤੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇਹ ਇਹਨਾਂ ਨੂੰ ਵਿਰਸੇ ਨੂੰ ਸਾਡੇ ਨੂੰ ਲੋਕ ਕਲਾਵਾਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਅਗਲੀ ਪੀੜ੍ਹੀ ਹੈ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਸਾਡੇ ਨੌਜਵਾਨ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਇਹਨਾਂ ਤੋਂ ਜਾਣੂ ਹੋ ਸਕਣ